ਇਹ ਗੱਲ ਮੰਨਣ ਯੋਗ ਹੈ ਕਿ ਪੁਰਾਣੀਆਂ ਪੀੜ੍ਹੀਆਂ ਛੋਟੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਧਾਰਮਿਕ ਸਨ ਪੁਰਾਣੀਆਂ ਪੀੜ੍ਹੀਆਂ ਦਾ ਜ਼ਿਆਦਾ ਧਿਆਨ ਪਾਠ ਪੂਜਾ ਵਿੱਚ ਲੱਗਦਾ ਸੀ ਅਜੋਕੇ ਯੁੱਗ ਦੀ ਨਵੀਂ ਪੀੜ੍ਹੀ ਜੋ ਕਿ ਛੋਟੀਆਂ ਪੀੜ੍ਹੀਆਂ ਹਨ ਉਹ ਜ਼ਿਆਦਾਤਰ ਵਿਦੇਸ਼ੀ ਪਹਿਰਾਵਾ ਵਿਦੇਸ਼ੀ ਸੱਭਿਆਚਾਰ ਅਪਣਾ ਰਹੀਆਂ ਹਨ ਵਿਦੇਸ਼ਾਂ ਦੇ ਨਾਲ ਜ਼ਿਆਦਾ ਜੁੜਨ ਕਰਕੇ ਇਹ ਆਪਣਾ ਸੱਭਿਆਚਾਰ ਧਾਰਮਿਕ ਸੱਭਿਆਚਾਰ ਭੁੱਲ ਰਹੀਆਂ ਹਨ ਧਰਮ ਦੇ ਨਾਲ ਨਾਲ ਇਹ ਆਪਣਾ ਸਾਰਾ ਹੀ ਕੁਛ ਗਵਾ ਬੈਠੇ ਹਨ ਨਾ ਹੀ ਇਹਨਾਂ ਨੂੰ ਕੋਈ ਪਾਠ ਪੂਜਾ ਦੀ ਮਰਿਆਦਾ ਦਾ ਪਤਾ ਹੈ ਅਤੇ ਨਾ ਹੀ ਗੁਰਦੁਆਰੇ ਜਾਣ ਸਮੇਂ ਦੀ ਮਰਿਆਦਾ ਦਾ ਪਤਾ ਹੈ ਵਿਦੇਸ਼ਾਂ ਦੇ ਨਾਲ ਜੁੜਨ ਕਰਕੇ ਇਹ ਆਪਣਾ ਧਾਰਮਿਕ ਸੱਭਿਆਚਾਰ ਗਵਾ ਚੁੱਕੇ ਹਨ ਪੁਰਾਣੇ ਸਮੇਂ ਵਿੱਚ ਆਮ ਘਰਾਂ ਦੀਆਂ ਬੀਬੀਆਂ ਵੀ ਗੁਟਕਾ ਸਾਹਿਬ ਤੋਂ ਪਾਠ ਕਰਦੀਆਂ ਸਨ ਅਜੋਕੇ ਸਮੇਂ ਵਿੱਚ ਜੋ ਕਿ ਬੀਬੀਆਂ ਨੇ ਫ਼ੋਨ ਤੋਂ ਪਾਠ ਕਰਦੀਆਂ ਹਨ ਫ਼ੋਨ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਫ਼ੋਨ ਦੇ ਨਾਲ ਨਾਲ ਬੱਚੇ ਜੁੜ ਚੁੱਕੇ ਹਨ ਫ਼ੋਨ ਦੇ ਨਾਲ ਜ਼ਿਆਦਾ ਜੁੜਨ ਕਾਰਨ ਬੱਚੇ ਆਪਣਾ ਧਰਮ ਭੁੱਲ ਗਏ ਹਨ